ਮੈਂ ਅਠਾਰ੍ਹਾਂ ਸਾਲ ਦੀ ਉਮਰ ਦੇ ਵਿੱਚ ਆਪਣੇ ਬਰਦਰ ਲਈ ਇੱਕ ਸਵੈਟਰ ਬਣਾਉਣਾ ਸ਼ੁਰੂ ਕੀਤਾ ਜੋ ਕਿ ਮੈਂ ਆਪਣੀ ਮਦਰ ਦੀ ਅਤੇ ਭਾਬੀ ਜੀ ਦੀ ਮਦਦ ਦੇ ਨਾਲ ਉਸ ਨੂੰ ਸਿੱਖਿਆ ਅਤੇ ਉਹ ਮੈਂ ਸਵੈਟਰ ਤਿਆਰ ਕੀਤਾ ਆਪਣੇ ਬ੍ਰਦਰ ਦੇ ਲਈ ਬਹੁਤ ਹੀ ਪਿਆਰ ਦੇ ਨਾਲ ਅਤੇ ਉਸ ਦੇ ਨਾਲ ਦੇ ਹੀ ਮੈਂ ਉਸ ਦਸਤਾਨੇ ਤਿਆਰ ਕੀਤੇ ਬੁਣਾਈ ਕੀਤੀ ਬਣਾਏ ਅਤੇ ਉਸ ਤੋਂ ਬਾਅਦ ਮੈਂ ਆਪਣੇ ਭਤੀਜੇ ਵਾਸਤੇ ਇੱਕ ਸਵੈਟ ਸੋਹਣੀ ਜਿਹੀ ਸਵੈਟਰ ਟੋਪੀ ਬੂਟ ਜੁਰਾਬਾ ਅਤੇ ਦਸਤਾਨੇ ਤਿਆਰ ਕੀਤੇ ਉਸ ਤੋਂ ਬਾਅਦ ਮੈਂ ਇੱਕ ਆਪਣੇ ਭਾਣਜੇ ਵਾਸਤੇ ਬਹੁਤ ਹੀ ਸੋਹਣੀ ਇਹ ਹੀ ਜਿਹੀ ਕੋਟੀ ਅਤੇ ਟੋਪੀ ਅਤੇ ਉਸ ਦੇ ਨਾਲ ਪਜਾਮੀ ਤਿਆਰ ਕੀਤੀ ਏ ਇਸ ਮੈਂ ਕਿ ਅਠਾਰ੍ਹਾਂ ਸਾਲ ਦੀ ਉਮਰ ਦੇ ਵਿੱਚ ਜਾਨੀ ਕਿ ਕਲਾ ਇਹ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਇਹ ਮੈਂ ਹੁਣ ਆਪਣੀ ਬੇਟੀ ਨੂੰ ਹੁਣ ਕਰੋਸ਼ੀਏ 'ਤੇ ਅਤੇ ਸਲਾਈਆਂ ਦੀ ਕਲਾ ਸਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਭਤੀਜੀ ਨੂੰ ਵੀ ਇਹ ਮੈਂ ਕਲਾ ਸਿਖਾਈ ਅਤੇ ਇਸੇ ਤਰੀਕੇ ਹੀ ਹੋਰ ਵੀ ਮੇਰੀ ਬੱਚੀ ਦੀ ਫਰੈਂਡ ਕੋਈ ਵੀ ਆਉਂਦੀ ਹੈ ਤਾਂ ਮੈਂ ਉਸ ਨੂੰ ਇਹ ਕਲਾ ਸਿਖਾਉਣ ਦੀ ਕੋਸ਼ਿਸ਼ ਕਰਦੀ ਆ ਤੇ ਬੱਚੀਆਂ ਨੂੰ ਮੈਂ ਆਪਣੇ ਆਪ ਦੇ ਨਿਰਭਰ ਹੋਣ ਦੀ ਹੀ ਕੋਸ਼ਿਸ਼ ਕਰਦੀ ਹਾਂ ਕਿ ਤੁਸੀਂ ਵੀ ਸਿੱਖੋ ਅਤੇ ਕਰੋ ਇਸ ਕਲਾ ਨੂੰ ਹੋਰ ਨਿਖਾਰੋ ਅਤੇ ਮੈਨੂੰ ਹਜੇ ਵੀ ਬਹੁਤ ਸ਼ੌਂਕ ਹੈ ਇਸ ਕਲਾ ਨੂੰ ਇਸ ਚੀਜ਼ ਨੂੰ ਬੁਣਾਈ ਕਰਨ ਦਾ ਕੋਟੀਆਂ ਸਵੈਟਰ ਬਣਾਉਣ ਦਾ ਹਜੇ ਵੀ ਮੈਨੂੰ ਬਹੁਤ ਸ਼ੌਂਕ ਹੈ